ਯੂਟਿਊਬ 'ਤੇ ਮੈਂ ਬਹੁਤ ਵਧੀਆ ਬਣਾਉਣ ਵਾਲੀਆਂ ਚੀਜ਼ਾਂ ਸਿੱਖਦਾ ਹਾਂ ਜਿਸ ਵਿੱਚ ਉਹ ਹਰੇਕ ਤਰ੍ਹਾਂ ਦਾ ਚੀਜ਼ ਸਿਖਾਉਂਦੇ ਹਨ ਉਸ ਵਿੱਚ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਨਵੀਂ ਚੀਜ਼ ਵਿੱਚ ਜੂਸ ਹੋ ਗਿਆ ਪਾਇਨਐਪਲ ਜੂਸ ਕਿਵੇਂ ਬਣਾਉਂਦੇ ਆ ਸ਼ਾਹੀ ਪਨੀਰ ਕਿਵੇਂ ਬਣਾਉਂਦੇ ਹਾਂ ਦਾਲ ਮੱਖਣੀ ਕਿਵੇਂ ਬਣਾਉਂਦੇ ਹੈ ਯੈਲੋ ਦਾਲ ਤੜਕਾ ਕਿਵੇਂ ਲੱਗਦਾ ਹੈ ਸੋਇਆਬੀਨ ਬੜੀਆਂ ਕਿਵੇਂ ਬਣਦੀਆਂ ਹਨ ਅਤੇ ਇਹਦੇ ਵਿੱਚ ਮੈਨੂੰ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਇੱਕ ਮੈਂ ਯੂ ਚੈਨਲ 'ਤੇ ਦੇਖ ਰਿਹਾ ਹਾਂ ਜਿਸ ਵਿੱਚ ਉਹਨਾਂ ਨੇ ਅੰਗੂਰਾਂ ਦਾ ਹਲਵਾ ਬਣਾਉਣਾ ਦੱਸਿਆ ਵੀ ਅੰਗੂਰਾਂ ਦਾ ਹਲਵਾ ਕਿਸ ਤਰ੍ਹਾਂ ਬਣਦਾ ਹੈ ਫਿਰ ਉਹਦੇ ਵਿੱਚ ਇੱਕ ਨਵੀਂ ਚੀਜ਼ ਸਿੱਖੀ ਜਿਹਦੇ ਵਿੱਚ ਉਹਨਾਂ ਨੇ ਜਾਮਨਾਂ ਦਾ ਜੂਸ ਕਿਵੇਂ ਬਣਦਾ ਹੈ ਅਤੇ ਜਾਮਨ ਵਿੱਚ ਜੂਸ ਬਣਦਾ ਹੈ ਅਤੇ ਜਾਮਨ ਨੂੰ ਕਿਵੇਂ ਇਸ ਜੂਸ ਦੇ ਨਾਲ ਨਾਲ ਆਪਣੀ ਹੈਲਥ ਦੇ ਵੀ ਕੰਮ ਆਉਂਦਾ ਹੈ ਇਸ ਵਿੱਚ ਅਸੀਂ ਜੋ ਚੀਜ਼ ਸਾਨੂੰ ਨਹੀਂ ਆਉਂਦੀ ਉਹ ਵੀ ਅਸੀਂ ਯੂਟਿਊਬ 'ਤੇ ਸਿੱਖ ਕੇ ਬਣਾ ਸਕਦੇ ਹਨ ਕੋਈ ਵੀ ਚੀਜ਼ ਲੈ ਲਉ ਰੋਟੀ ਲੈ ਲਉ ਦਾਲ ਲੈ ਲਉ ਬਰਫੀ ਲੈ ਲਉ ਗੁਲਾਬ ਜਾਮਣ ਲੈ ਲਉ ਰਸ ਮਲਾਈ ਲੈ ਲਉ ਪਨੀਰ ਹੈ ਕਿਵੇਂ ਬਣਦਾ ਹੈ ਦਹੀਂ ਕਿਵੇਂ ਜੰਮਦਾ ਹੈ ਕੋਈ ਵੀ ਚੀਜ਼ ਹੈ ਅਸੀਂ ਬਹੁਤ ਜਲਦੀ ਅਤੇ ਆਸਾਨੀ ਤਰੀਕੇ ਨਾਲ ਸਿੱਖ ਜਾਂਦੇ ਹਨ ਇਸ ਲਈ ਸਾਨੂੰ ਯੂਟਿਊਬ 'ਤੇ ਦੇਖ ਕੇ ਚੀਜ਼ ਅਸੀਂ ਬਣਾ ਲੈਂਦੇ ਹਨ ਅਤੇ ਸਪੈਸ਼ਲ ਸਾਨੂੰ ਕੋਈ ਕੁੱਕ ਦੀ ਜ਼ਰੂਰਤ ਨਹੀਂ ਪੈਂਦੀ